ਭਾਰਤ ਵਿੱਚ ਆਵਾਜਾਈ ਦੇ ਬਹੁਤ ਜ਼ਿਆਦਾ ਸਾਧਨ ਪਾਏ ਜਾਂਦੇ ਹਨ ਜਿਵੇਂ ਕਿ ਮੋਟਰਸਾਈਕਲ ਮੋਟਰਸਾਈਕਲ 'ਤੇ ਅਸੀਂ ਦੋ ਜਣੇ ਹੀ ਦੋ ਜਣੇ ਦੋ ਜਣੇ ਹੀ ਸਫ਼ਰ ਕਰ ਸਕਦੇ ਹਾਂ ਤੀਸਰੇ ਬੰਦਾ ਸਫ਼ਰ ਕਰਨ ਨਾਲ਼ ਬੰਦੇ ਦਾ ਚਲਾਨ ਹੋ ਸਕਦਾ ਹੈ ਆਟੋ ਆਟੋ ਵਿੱਚ ਅਸੀਂ ਜ਼ਿਆਦਾ ਜ਼ਿਆਦਾ ਲੰਬਾ ਸਫ਼ਰ ਨਹੀਂ ਕਰ ਸਕਦੇ ਕਾਰਾਂ ਕਾਰਾਂ ਵਿੱਚ ਆਪਾਂ ਜ਼ਿਆਦਾ ਆਮ ਜ਼ਿਆਦਾ ਦੂਰ ਤੱਕ ਨਹੀਂ ਜਾ ਸਕਦੇ ਜਿਸ ਵਿੱਚ ਬੈਠ ਕੇ ਸਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਟਰੇਨ ਜਿਸ ਵਿੱਚ ਬਹੁਤ ਜ਼ਿਆਦਾ ਖੱਜਲ ਖੁਆਰੀ ਹੁੰਦੀ ਹੈ ਨਾਲ਼ੇ ਛ ਟਰੇਨਾਂ ਛੋਟੇ ਸ਼ਹਿਰਾਂ ਵਿੱਚ ਉਪਲਬਧ ਨਹੀਂ ਹਨ ਬੱਸ ਜਿਸ ਵਿੱਚ ਬੱਸ ਵਿੱਚ ਬਹੁਤ ਬਹੁਤ ਜ਼ਿਆਦਾ ਟਾਈਮਿੰਗ ਵੇਸਟ ਐਂਡ ਖੱਜਲ ਖੁਆਰੀ ਹੁੰਦੀ ਹੈ ਅਤੇ ਵਾਰ ਵਾਰ ਬੱਸਾਂ ਚੇਂਜ ਕਰਨੀਆਂ ਪੈਂਦੀਆ ਹਨ ਹਵਾਈ ਜਹਾਜ਼ ਜੋ ਕਿ ਛੋਟੇ ਸ਼ਹਿਰਾਂ ਵਿੱਚ ਨਹੀਂ ਹੈ ਇਸ ਲਈ ਇਸ ਦਾ ਬਹੁਤ ਜ਼ਿਆਦਾ ਮਹਿੰਗੀਆਂ ਹਨ ਕਿਸ਼ਤੀਆਂ ਜੋ ਕਿ ਉਪਲਬਧ ਨਹੀਂ ਹਨ ਸਮੁੰਦਰਾਂ ਵਿੱਚ ਹੀ ਉਪਲਬਧ ਹਨ ਐਂਡ ਟਿਕਟਾਂ ਵੀ ਬੱਸਾਂ ਦੀਆਂ ਟਿਕਟਾਂ ਘੱਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਬੱਸਾਂ ਵਧਾਉਣੀਆਂ ਚਾਹੀਦੀਆਂ ਹਨ ਰੇਲਵੇ ਸਟੇਸ਼ਨ ਵੀ ਛੋਟੇ ਛੋਟੇ ਸ਼ਹਿਰਾਂ ਵਿੱਚ ਉਪਲਬਧ ਕਰਨੇ ਚਾਹੀਦੇ ਹਨ ਜਹਾਜ਼ ਦੀਆਂ ਟਿਕਟਾਂ ਸਸਤੀਆਂ ਹੋਣੇ ਚਾਹੀਦੀਆਂ ਜੋ ਕਿ ਆਮ ਬੰਦਾ ਵੀ ਸਫ਼ਰ ਕਰ ਸਕੇ